ਪੰਜਾਬੀ ਸੱਭਿਆਚਾਰ ਵਿੱਚ ਤਾਂ ਭੰਗੜਾ ਤਾਂ ਬਹੁਤ ਹੀ ਮਹੱਤਤਾ ਆ ਜੀ ਪਹਿਲਾਂ ਤਾਂ ਕੋਈ ਥੋੜ੍ਹਾ ਟਾਈਮ ਪਹਿਲੇ ਕੋਈ ਇੱਦਾਂ ਖੋ ਗਿਆ ਸੀ ਥੋੜ੍ਹਾ ਜਿਹਾ ਆਪਣਾ ਮਤਲਬ ਲੋਕੀ ਨਹੀਂ ਸੀ ਇਹਨੂੰ ਜਾਣਦੇ ਪਹਿਚਾਣਦੇ ਬਹੁਤ ਪੁਰਾਣੇ ਟਾਈਮ ਦੇ ਉੱਤੇ ਬਹੁਤ ਨੱਚਦੇ ਸੀ ਇਹਦੇ ਉੱਪਰ ਪਰ ਅੱਜ ਕੱਲ੍ਹ ਤਾਂ ਮੈਂ ਕਹਿੰਦੀ ਹਾਂ ਬਹੁਤ ਲੋਕ ਇਹਦੇ ਪਿੱਛੇ ਕਰੇਜੀ ਹੋ ਗਏ ਨੇ ਕਿਉਂ ਕਿੱਦਾਂ ਹੋ ਗਏ ਪਤਾ ਕੀ ਗੱਲ ਹੈ ਇਹ ਨਾ ਵਿਆਹ ਸ਼ਾਦੀਆਂ ਵਿੱਚ ਤਾਂ ਇਸ ਤੋਂ ਬਗੈਰ ਰੋਣਕ ਹੀ ਨਹੀਂ ਲੱਗਦੀ ਇੰਨਾਂ ਲੋਕੀ ਨੱਚਦੇ ਟੱਪਦੇ ਨੇ ਜਦੋਂ ਭੰਗੜਾ ਹੁੰਦਾ ਆਪਣੇ ਆਪ ਹੀ ਸਾਰੇ ਪੈਰ ਵਜਨੇ ਸ਼ੁਰੂ ਹੋ ਜਾਂਦੇ ਸਭ ਦੇ ਪਰ ਜਿਹੜੇ ਅੱਜ ਕੱਲ੍ਹ ਨੌਜਵਾਨ ਨੇ ਉਹ ਵੀ ਇੱਦਾਂ ਹੀ ਬਸ ਜਿਮ ਵਗੈਰਾ ਵਿੱਚ ਭੰਗੜੇ ਲਾ ਲਾ ਕੇ ਆਪਣੇ ਫਿਟਨੈਸ ਕਰੀ ਜਾਂਦੇ ਪਏ ਨੇ ਬਸ ਬਹੁਤ ਵਧੀਆ ਅੱਜ ਕੱਲ੍ਹ ਅਤੇ ਭੰਗੜਾ ਤਾਂ ਇੰਨਾਂ ਵਧੀਆ ਨਾ ਕਿ ਜਦੋਂ ਅਸੀਂ ਜਦੋਂ ਨੱਚਦੇ ਹਾਂ ਨਾ ਸਾਨੂੰ ਆਪਣੇ ਆਪ ਹੀ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਕੀ ਕਰਦੇ ਪਏ ਹਾਂ ਪਰ ਅਸੀਂ ਭੰਗੜਾ ਪਾਈ ਜਾਂਦੇ ਹਾਂ ਬਹੁਤ ਵਧੀਆ ਮਜ਼ਾ ਆਉਂਦਾ ਹੈ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਸਾਨੂੰ ਅਤੇ ਵੈਸੇ ਸਰ ਹਰ ਕਿਸੇ ਨੂੰ ਰੋਜ਼ ਦੀ ਰੂਟੀਨ ਵਿੱਚ ਨਾ ਭੰਗੜਾ ਪਾਉਣਾ ਹੀ ਚਾਹੀਦਾ